ਰਾਜ ਵਿੱਚ ਸਿੱਖਿਆ ਪ੍ਰਣਾਲੀ ਵਿੱਚ ਪੰਜਾਬੀ ਭਾਸ਼ਾ ਬਹੁਤ ਵਧੀਆ ਭੂਮਿਕਾ ਨਿਭਾਉਂਦੀ ਹੈ ਕਿਉਂਕਿ ਪੰਜਾਬੀ ਭਾਸ਼ਾ ਸਾਡੀ ਮਾਂ ਬੋਲੀ ਹੈ ਸਿੱਖਿਆ ਪ੍ਰਣਾਲੀ ਵਿੱਚ ਕਈ ਦਹਾਕਿਆਂ ਤੋਂ ਬਾਅਦ ਸ਼ਾਨਦਾਰ ਬਦਲਾਵ ਕੀਤੇ ਗਏ ਹਨ ਇਹਨਾਂ ਦਾ ਸਵਾਗਤ ਕਰਨਾ ਚਾਹੀਦਾ ਹੈ ਇਸ ਨੀਤੀ ਇਸ ਸਿੱਖਿਆ ਨੀਤੀ ਦੇ ਨਾਲ ਅੰਤਰਰਾਸ਼ਟਰੀ ਸਿੱਖਿਆ ਦੇ ਪੱਧਰ ਅਤੇ ਸਾਡੀ ਸਿੱਖਿਆ ਪ੍ਰਣਾਲੀ ਸਮਾਂਤਰ ਹੋ ਗਈ ਹੈ ਸਭ ਤੋਂ ਜ਼ਿਆਦਾ ਸ਼ਲਾਘਾਯੋਗ ਕਦਮ ਹੈ ਪ੍ਰਾਇਮਰੀ ਸਿੱਖਿਆ ਮਾਂ ਬੋਲੀ ਵਿੱਚ ਦੇਣਾ ਮੁੱਢਲੀ ਸਿੱਖਿਆ ਜੇਕਰ ਉਸਦੀ ਮਾਂ ਬੋਲੀ ਵਿੱਚ ਹੋਵੇ ਤਾਂ ਸਿੱਖਿਆ ਦੀ ਨੀਂਹ ਨੂੰ ਪਕੇਰਾ ਕਰਦੀ ਹੈ ਜਿਸ ਉੱਪਰ ਸਿੱਖਿਆ ਦੇ ਮੁਨਾਰੇ ਚਮਕਦੇ ਹਨ ਉਸ ਤੋਂ ਬਾਅਦ ਗੱਲ ਕਰਾਂ ਤਾਂ ਇਸ ਨਵੀਂ ਨੀਤੀ ਤਹਿਤ ਬੱਚਾ ਆਪਣੀ ਮਾਂ ਬੋਲੀ ਵਿੱਚ ਮੁੱਢਲੀ ਸਿੱਖਿਆ ਪ੍ਰਾਪਤ ਕਰੇਗਾ ਉਸਦੇ ਉੱਪਰ ਤਿੰਨ ਤਿ ਤਿੰਨ ਅਲੱਗ ਅਲੱਗ ਭਾਸ਼ਾਵਾਂ ਸਿੱਖਣ ਦਾ ਬੋਝ ਨਹੀਂ ਪਵੇਗਾ ਜੋ ਬੋਲੀ ਜਾਂ ਭਾਸ਼ਾ ਉਸਦੇ ਘਰ ਵਿੱਚ ਅਤੇ ਆਲ਼ੇ ਦੁਆਲੇ ਵਿੱਚ ਵਰਤੀ ਜਾਂਦੀ ਹੈ ਉਹ ਉਸਨੇ ਲਿਖਣੀ ਹੈ ਅਤੇ ਪੜ੍ਹਨੀ ਸਿੱਖਣੀ ਹੈ ਇਸ ਨਾਲ ਬੱਚਾ ਮਾਨਸਿਕ ਰੂਪ ਵਿੱਚ ਵਧੀਆ ਵਿਕਾਸ ਕਰੇਗਾ ਅਜਿਹਾ ਵਿਦਿਆਰਥੀ ਜਦੋਂ ਸਿੱਖਿਆ ਦੇ ਅਗਲੇ ਪੜਾਅ ਵਿੱਚ ਪਹੁੰਚੇਗਾ ਤਾਂ ਮਾਨਸਿਕ ਰੂਪ ਵਿੱਚ ਦੂਜੀਆਂ ਭਾਸ਼ਾਵਾਂ ਨੂੰ ਸਿੱਖਣ ਲਈ ਤਿਆਰ ਹੋਵੇਗਾ ਉਸ ਦੇ ਲਈ ਹੋਰ ਭਾਸ਼ਾਵਾਂ ਸਿੱਖਣਾ ਸਰਲ ਹੋਵੇਗਾ